ਸਾਨੂੰ ਆਪਣੇ ਬਗੀਚੇ ਦੀ ਸਾਂਭ ਸੰਭਾਲ ਕਰਨ ਵੇਲੇ ਕਾਫੀ ਮੁਸ਼ਕਿਲ ਆਉਂਦੇ ਹਨ ਜਿਵੇਂ ਬਗੀਚੇ ਨੂੰ ਸੰਭਾਲ ਕੇ ਰੱਖਣਾ ਆਪਣਾ ਸ਼ੌਂਕ ਹੁੰਦੇ ਹਨ ਜਿਵੇਂ ਉਸ ਵਿੱਚ ਫੁੱਲਦਾਰ ਬੂਟੇ ਹੋਣ ਜਾਂ ਫਲਦਾਰ ਬੂਟੇ ਹੋਣ ਉਹਨਾਂ ਨੂੰ ਪੈਦਾ ਕਰਨ ਲਈ ਸਾਨੂੰ ਪਹਿਲਾਂ ਹੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਮੱਸਰ ਕੀੜੇ ਮਕੌੜੇ ਆਦਿ ਹੋਰ ਬਹੁਤ ਕੁਛ ਪੈਂਦਾ ਮਾ ਮਾਰ ਕਰਦੇ ਨੇ ਇਨ੍ਹਾਂ 'ਤੇ ਸਾਨੂੰ ਇਹਨਾਂ 'ਤੇ ਟੈਮ ਟੂ ਟੈਮ ਸਪਰੇਆਂ ਕਰਨੀਆਂ ਪੈਂਦੀਆਂ ਹਨ ਜਿਵੇਂ ਛੋਟੀ ਪਨੀਰੀ ਦੇ ਵਿੱਚ ਪਾਣੀ ਵੱਧ ਦੇ ਦਈਏ ਉਹ ਮਰ ਜਾਂਦੀ ਹੈ ਜੀ ਜਾਂ ਫਿਰ ਸੋਕਾ ਪੈ ਜਾਵੇ ਤਾਂ ਉਹ ਮਰ ਜਾਂਦੀ ਹੈ ਸਾਨੂੰ ਬਹੁਤ ਸਾਂਭ ਸੰਭਾਲ ਕਰਨੀ ਪੈਂਦੀ ਆ ਜਿਵੇਂ ਠੰਡ ਦੇ ਵਿੱਚ ਕੋਰਾ ਪੈ ਜਾਵੇ ਤਾਂ ਮਰ ਜਾਂਦੀ ਹੈ ਸਾਨੂੰ ਇਹਨੂੰ ਬਹੁਤ ਧਿਆਨ ਨਾਲ ਪਾਲਣੀ ਪੈਂਦੀ ਹੈ ਟਾਇਮ ਨਾਲ ਇਹਦੀ ਸਪਰੇਅ ਕਰਨੀ ਪੈਂਦੀ ਆ ਤਾਂ ਉਸ ਤੋਂ ਬਾਅਦ ਕਿਤੇ ਸਾਨੂੰ ਇਹ ਫਲ ਜਾਂ ਫੁੱਲ ਦਿੰਦੀ ਹੈ